ਤਾਂ ਪ੍ਰਸ਼ਨ ਕੁਛ ਇਸ ਪ੍ਰਕਾਰ ਹੈ ਤੁਸੀਂ ਪੇਂਟਿੰਗ ਨੂੰ ਕੰਮ ਅਤੇ ਪਰਿਵਾਰਿਕ ਵਚਨਬੰਧਤਾਵਾਂ ਨਾਲ ਕਿਵੇਂ ਸੰਤੁਲਿਤ ਕਰਦੇ ਹੋ ਅਤੇ ਜਾਂ ਤਾਂ ਬਹੁਤ ਮਤਲਬ ਸਰਲ ਜਵਾਬ ਹੈ ਇਹਦਾ ਕਿ ਮਤਲਬ ਜੇ ਬੰਦਾ ਆਪਣਾ ਕੰਮ ਪੂਰਾ ਟਾਈਮ ਸਿਰ ਨਾਲ ਕਰ ਲਵੇ ਟਾਈਮ ਨਾਲ ਕਰ ਲਵੇ ਅਤੇ ਮਤਲਬ ਉਹ ਕਰ ਸਕਦਾ ਮੈਨੇਜ ਹਰ ਇੱਕ ਚੀਜ਼ ਨੂੰ ਮੈਨੇਜ ਕਰ ਸਕਦਾ ਵਾ ਸਵੇਰੇ ਜਿਵੇਂ ਸਵੇਰੇ ਜਲਦੀ ਉੱਠਣਾ ਚਾਹੀਦਾ ਇੱਦਾਂ ਨਹੀਂ ਕਿ ਦਸ ਦਸ ਵਜੇ ਤੱਕ ਉੱਠੇ ਬੰਦਾ ਆ ਤਾਂ ਬਹੁਤ ਗਲਤ ਬਹੁਤ ਗਲਤ ਆਦਤ ਹੈ ਇਹੋ ਜਿਹੀ ਆਦਤ ਤਾਂ ਕਦੇ ਹੋਣੀ ਨਹੀਂ ਚਾਹੀਦੀ ਜ਼ਿੰਦਗੀ 'ਚ ਸਵੇਰੇ ਛੇ ਵਜੇ ਉੱਠਣਾ ਚਾਹੀਦਾ ਹੈ ਛੇ ਨਹੀਂ ਉਸ ਤੋਂ ਵੀ ਪਹਿਲਾਂ ਉੱਠਣਾ ਚਾਹੀਦਾ ਅੰਮ੍ਰਿਤ ਵੇਲੇ ਉੱਠ ਕੇ ਸਾਨੂੰ ਅਰਦਾਸ ਕਰਨੀ ਚਾਹੀਦੀ ਹੈ ਪਾਠ ਕਰਨਾ ਚਾਹੀਦਾ ਰੱਬ ਦਾ ਗੁਣ ਗਾਣੇ ਚਾਹੀਦੇ ਹੈ ਜਿਸ ਨਾਲ ਸਾਡਾ ਰੱਬ ਨਾਲ ਵੀ ਮੇਲ ਮਿਲਿਆ ਰਹੇ ਅਤੇ ਸਾਡਾ ਪ੍ਰਕਰਤੀ ਨਾਲ ਵੀ ਮੇਲ ਮਿਲਿਆ ਜੇ ਸ਼ੁੱਧ ਹਵਾ ਦਾ ਅਨੁਭਾਦ ਕਰੋ ਸਵੇਰੇ ਉੱਠੋ ਅਤੇ ਉਸ ਤੋਂ ਬਾਅਦ ਮਤਲਬ ਕਿ ਆਪਣੀ ਐਕਸਰਸਾਈਜ਼ ਕਰੋ ਥੋੜ੍ਹੀ ਕਸਰਤਾਂ ਕਰੋ ਮਤਲਬ ਇੱਦਾਂ ਅਤੇ ਸਵੇਰ ਦੇ ਸਮੇਂ ਤਾਂ ਪੇਂਟਿੰਗ ਦਾ ਆਨੰਦ ਹੀ ਬਹੁਤ ਆਉਂਦਾ ਵਾ ਸਵੇਰੇ ਕਲਮ ਜਦੋਂ ਹੱਥ 'ਚ ਅਤੇ ਕਾਗਜ਼ ਚਿੱਟੇ 'ਤੇ ਲਿਖੇ ਜਾਵੇ ਸ਼ਬਦ ਆਹਾ ਕਿਆ ਆਨੰਦ ਵਾਲੀ ਗੱਲ ਕਹਿ ਦਿੱਤੀ ਮੈਂ ਅਤੇ ਵਾਹ ਵਾਹ ਵਾਹ ਹੋਰ ਜ਼ਿੰਮੇਵਾਰੀ ਨੂੰ ਪੂਰਾ ਕਰ ਕਰਦੇ ਹੋਏ ਤੁਹਾਡੇ ਨਾਲ ਪੇਂਟਿੰਗ ਅਤੇ ਕਾਫ਼ੀ ਸਮਾਂ ਅਤੇ ਊਰਜਾ ਹੈ ਕਿ ਯਕੀਨੀ ਬਣਾਉਣ ਲਈ ਕੋਈ ਰਣ ਰਣਨੀਤੀ ਹੀ ਤਾਂ ਦੱਸ ਰਿਹਾ ਮੈਂ ਤੁਹਾਨੂੰ ਸਵੇਰੇ ਉੱਠੋ ਸਵੇਰੇ ਉੱਠਿਆ ਮੈਂ ਜਿਵੇਂ ਮੈਂ ਤੁਹਾਨੂੰ ਆਪਣੀ ਰਣਨੀਤੀ ਮੈਂ ਆਪਣਾ ਉਹ ਦੱਸਦਾਂ ਕਿ ਮੇਰਾ ਕੀ ਉੱਠਣ ਦਾ ਵਿਚ ਉੱਠਦਾ ਕਿਵੇਂ ਹਾਂ ਵਗੈਰਾ ਵਗੈਰਾ ਮੈਂ ਤੁਹਾਨੂੰ ਸਭ ਦੱਸਦਾਂ ਸੁਣੋ ਜਿਵੇਂ ਸਵੇਰੇ ਮੈਂ ਉੱਠ ਗਿਆ ਚਾਰ ਵਜੇ ਅੰਮ੍ਰਿਤ ਵੇਲੇ ਉੱਠ ਕੇ ਰੱਬ ਦੇ ਰੰਗਾਂ 'ਚ ਮਿਲ ਜਾਂਦਾ ਮੈਂ ਅੰਮ੍ਰਿਤ ਵੇਲੇ ਉੱਠ ਕੇ ਰੱਬ ਦੇ ਰੰਗਾਂ 'ਚ ਮਿਲ ਜਾਂਦਾ ਮੈਂ ਅਤੇ ਉਸ ਤੋਂ ਬਾਅਦ ਕਲਮ ਫੜ ਕੇ ਕਿਤਾਬਾਂ 'ਚ ਰਲ ਜਾਂਦਾ ਮੈਂ ਕਿਆ ਬਾਤ ਮੈਂ ਹੁਣੇ ਲਿਖਿਆ ਸ਼ਾਇਰੀ ਤੁਹਾਨੂੰ ਪਤਾ ਹੋਣਾ ਚਾਹੀਦਾ ਵਾ ਕਿ ਤੁਸੀਂ ਆਪਣਾ ਸਮੇਂ ਕਿਸ ਨਾਲ ਬਿਤਾਓਗੇ ਅਤੇ ਉਸ ਤੋਂ ਬਾਅਦ ਉਠੋ ਕਾਲਜ ਦੀ ਕਾਲਜ ਜਾਂਦੇ ਹੋ ਕੰਮ ਕਰਦੇ ਉਹ ਕੰਮ ਕਰੋ ਅਤੇ ਉਸ ਤੋਂ ਬਾਅਦ ਸਮਾਂ ਬਹੁਤ ਹੈ ਸਮਾਂ ਹੀ ਸਮਾਂ ਜ਼ਿੰਦਗੀ 'ਚ ਸਮਾਂ ਬਹੁਤ ਪਰੀਸ਼ਿਅਸ ਹੁੰਦਾ ਵਾ ਟਾਈਮ ਇਜ ਮਨੀ ਪੈਸਾ ਹੀ ਤਾਂ ਧਨ ਦੌਲਤ ਸਭ ਕੁਛ ਹੈਗਾ ਜਿਸ ਕਰਕੇ ਤਾਂ ਮੈਂ ਆਹ ਕਰ ਰਿਹਾ ਅਤੇ ਹੋਰ ਤੁਸੀਂ ਮੈਂ ਕੀ ਕਹਾਂ ਤੁਹਾਨੂੰ